ਹਾਂ ਸਾਡੇ ਫਿਊਚਰ ਵਿੱਚ ਵੀ ਇਹ ਕੈਂਪ ਲਗਾਏ ਜਾਂਦੇ ਹਨ ਜਿਵੇਂ ਕਿ ਕੱਪੜੇ ਸੀਨ ਦਾ ਕੱਪੜਿਆਂ ਤੇ ਕੜਾਈ ਕਰਨ ਦਾ ਬਿਊਟੀ ਪਾਰਲਰ ਦਾ ਹੋਰ ਵੀ ਬਥੇਰੇ ਕੈਂਪ ਲਗਾਏ ਜਾਂਦੇ ਹਨ ਪਿਛਲੇ ਕੁਝ ਮਹੀਨਿਆਂ ਚ ਸਾਡੇ ਸ਼ਹਿਰ ਵਿੱਚ ਇੱਕ ਕੈਂਪ ਲੱਗਿਆ ਸੀ ਜਿਸ ਵਿੱਚ ਸਾਨੂੰ ਸਿਲਾਈ ਦਾ ਕੰਮ ਸਿਖਾਇਆ ਗਿਆ ਸੀ ਉਸ ਵਿੱਚ ਸਾਨੂੰ ਗਲੇ ਦੇ ਡਿਜ਼ਾਇਨ ਵੀ ਬਥੇਰੇ ਸਿਖਾਏ ਗਏ ਸਨ ਕੜਾਈ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਸਾਨੂੰ ਸਿਖਾਇਆ ਗਿਆ ਸੀ ਬਿਊਟੀ ਪਾਰਲਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਚੀਜ਼ ਲਗਾਉਣੀ ਹੈ ਤੇ ਕਿਵੇਂ ਲਾਉਣੀ ਹੈ ਇਹ ਵੀ ਸਾਨੂੰ ਸਿਖਾਇਆ ਗਿਆ ਸੀ ਹੋਰ ਵੀ ਬਹੁਤ ਚੀਜ਼ਾਂ ਸਾਨੂੰ ਵਧੀਆ ਲੱਗੀਆਂ ਜਿਸ ਵਿੱਚ ਕਿ ਕਿਹੜੇ ਕਿਹੜੇ ਪ੍ਰੋਡਕਟ ਯੂਜ ਕਰਨੇ ਹਨ ਜਿਵੇਂ ਕਿ ਕਿਹੜਾ ਧਾਗਾ ਯੂਜ ਕਰਨਾ ਹੈ ਕਿਹੜੇ ਕੱਪੜੇ ਤੇ ਕਿਹੜੀ ਸੂਈ ਚੱਲੇਗੀ ਜਿਵੇਂ ਗਿਆਰਾਂ ਨੰਬਰ ਸੂਈ ਹੋ ਗਈ ਸੋਲਾਂ ਨੰਬਰ ਅਲੱਗ ਅਲੱਗ ਨੰਬਰ ਹੁੰਦੇ ਨੇ ਅਲੱਗ ਅਲੱਗ ਕੱਪੜਿਆਂ ਵਾਸਤੇ ਜਿਵੇਂ ਸਟੀਚਿੰਗ ਦਾ ਕੋਈ ਕੱਪੜਾ ਹੁੰਦਾ ਹੈ ਉਹਦੇ ਵਾਸਤੇ ਅਲੱਗ ਸੂਈ ਲੱਗਦੀ ਹੈ ਕਾਟਨ ਦੇ ਕੱਪੜੇ ਵਾਸਤੇ ਅਲੱਗ ਸੂਈ ਲੱਗਦੀ ਹੈ ਐਵੇਂ ਐਵੇਂ ਬਹੁਤ ਚੀਜ਼ਾਂ ਸਾਨੂੰ ਕੁਝ ਸਿਖਾਈਆਂ ਗਈਆਂ ਹਨ ਤੇ ਇਸ ਦੀ ਸਲਾਹ ਮੈਂ ਆਪਣੇ ਵੱਡਿਆਂ ਕੋਲੋਂ ਲਵਾਂਗੀ ਕਿ ਸਾਨੂੰ ਕਿਸ ਚੀਜ਼ ਕੋਈ ਕਿਹੜਾ ਕੰਮ ਸਾਨੂੰ ਕੰਮ ਆ ਸਕਦਾ ਹੈ ਤੇ ਕੋਈ ਕੰਮ ਨਹੀਂ ਆ ਸਕਦਾ